ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਰਹਿੰਦੇ ਹਾਂ ਅਤੇ ਉੱਥੇ ਇੱਕ ਬਹੁਤ ਹੀ ਇਤਿਹਾਸਿਕ ਘਟਨਾ ਵਾਪਰੀ ਸੀ ਜੋ ਕਿ ਗੁਰੂ ਗੋਬਿੰਦ ਸਾਡੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਉਹਨਾਂ ਨੂੰ ਵਜ਼ੀਰ ਖਾਂ ਦੇ ਦੁਆਰਾ ਸ਼ਹੀਦੀਆਂ ਦੇ ਦਿੱਤੀਆਂ ਗਈਆਂ ਸੀ ਅਤੇ ਉਹਨਾਂ ਨੂੰ ਇੱਕ ਜੋ ਕਿ ਸੱਤ ਸਾਲ ਦੇ ਸੀ ਅਤੇ ਜੋ ਦੂਜੇ ਨੌ ਸਾਲ ਦੇ ਸੀ ਉਹਨਾਂ ਨੂੰ ਸ਼ਹੀਦੀਆਂ ਦੇ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਸਾਡੇ ਸਿੱਖ ਇਤਿਹਾਸ ਕੌਮ ਦੇ ਨਾਲ ਜੁੜੀ ਹੋਈ ਘਟਨਾ ਹੈ ਅਤੇ ਇਹ ਮੈਂ ਬਹੁਤ ਹੀ ਮਾਣ ਮਹਿਸੂਸ ਕਰਦੀ ਹਾਂ ਕਿ ਅਸੀਂ ਇਹੋ ਜਿਹੇ ਇਲਾਕੇ ਦੇ ਵਿੱਚ ਰਹਿੰਦੇ ਹਾਂ ਅਤੇ ਇਹ ਸਾਡੇ ਲਈ ਬਹੁਤ ਹੀ ਫ਼ਕਰ ਦੀ ਗੱਲ ਹੈ ਉਹਨਾਂ ਨੇ ਇੰਨੀ ਜ਼ਿਆਦਾ ਠੰਢ ਦੇ ਵਿੱਚ ਠੰਢੇ ਬੁਰਜ ਦੇ ਵਿੱਚ ਰਹਿ ਕੇ ਰਾਤਾਂ ਗੁਜ਼ਾਰੀਆਂ ਅਤੇ ਉਹ'ਨਾਂ 'ਤੇ ਬਹੁਤ ਹੀ ਕਹਿਰ ਬੀਤਿਆਂ ਸੀ ਇਹ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ